ਵੈਸੇ ਤਾਂ ਮੈਨੂੰ ਰਵਾਇਤੀ ਤੌਰ 'ਤੇ ਪੈੱਨ ਨਾਲ ਕਾਗਜ਼ 'ਚ ਲਿਖਣਾ ਬਹੁਤ ਪਸੰਦ ਹੈ ਅੱਗੇ ਮੈਂ ਜਿੱਥੇ ਵੀ ਕਿਤੇ ਘੁੰਮਣ ਜਾਂਦੀ ਹੁੰਦੀ ਸੀ ਮੇਰੇ ਕੋਲ ਹਮੇਸ਼ਾ ਇੱਕ ਸਲਾਈਟਲੀ ਛੋਟੀ ਜਿਹੀ ਡਾਇਰੀ ਅਤੇ ਇੱਕ ਪੈੱਨ ਹੁੰਦਾ ਸੀ ਜਿਸ ਨਾਲ ਮੈਂ ਕੋਈ ਵੀ ਮੂਵਮੈਂਟ ਕੋਈ ਵੀ ਚੀਜ਼ ਜੋ ਵੀ ਮੇਰੇ ਦਿਮਾਗ 'ਚ ਆਉਂਦੀ ਸੀ ਮੈਂ ਉਹਨੂੰ ਡਾਇਰੀ 'ਤੇ ਨੋਟ ਕਰ ਲੈਂਦੀ ਸੀ ਅਤੇ ਆਪਣਾ ਕੋਈ ਵੀ ਮੂਮਮੈਂਟ ਕੈਪਚਰ ਕਰਨਾ ਹੋਵੇ ਤਾਂ ਮੈਂ ਪੈੱਨ ਨਾਲ ਕਾਗਜ਼ 'ਤੇ ਲਿਖ ਲੈਂਦੀ ਸੀ ਆਪਣੀ ਡਾਇਰੀ 'ਤੇ ਅਤੇ ਐਜ ਜਦੋਂ ਵੀ ਹੁਣ ਥੋੜ੍ਹੇ ਸਾ ਕੁਝ ਕੁ ਸਾਲਾਂ ਤੋਂ ਟੈਕਨਾਲੋਜੀ ਚੇਂਜ ਹੋਈ ਅਤੇ ਆਪਾਂ ਮੋਬਾਈਲ ਵਗੈਰਾ ਯੂਜ ਕਰਦੇ ਹਾਂ ਹੁਣ ਮੋਬਾਈਲ ਵਿੱਚ ਹੀ ਆਪਣੀ ਇੱਕ ਮਿਨੀ ਡਾਇਰੀ ਹੁੰਦੀ ਹੈ ਜਿਸ ਵਿੱਚ ਜਿਵੇਂ ਆਪਾਂ ਮੈਸੇਜ ਕਿਸੇ ਨੂੰ ਸੈਂਡ ਕਰਨਾ ਹੋਵੇ ਆਪਾਂ ਟਾਈਪ ਕਰਦੇ ਹਾਂ ਐਵੇਂ ਹੀ ਮੈਨੂੰ ਕੁਛ ਵੀ ਕੋਈ ਡੇਟ ਵਾਈਜ਼ ਕੁਝ ਮੂਮਮੈਂਟ ਕੋਈ ਬਰਥਡੇ ਕਿਸੀ ਫਰੈਂਡ ਦਾ ਐਨੀਵਰਸਰੀ ਕੁਛ ਵੀ ਅਗਰ ਮੈਨੂੰ ਲਿਖਣਾ ਹੋਵੇ ਉਸ ਦਿਨ ਰਿਗਾਰਡਿੰਗ ਜੇ ਕੋਈ ਮੂਮਮੈਂਟ ਰਿਗਾਰਡਿੰਗ ਮੈਨੂੰ ਲਿਖਣਾ ਹੋਵੇ ਮੈਂ ਆਪਣੀ ਮੋਬਾਈਲ 'ਚ ਇੱਕ ਮਿਨੀ ਡਾਇਰੀ ਬਣਾਈ ਹੋਈ ਹੈ ਫੋਲਡਰ ਤੋਂ ਅਤੇ ਮੈਂ ਉਸ ਵਿੱਚ ਉਹ ਟਾਈਪ ਕਰਕੇ ਸੇਵ ਕਰ ਲੈਂਦੀ ਹਾਂ